ਮੈਨੂੰ ਪਾਲਤੂ ਪਸ਼ੂ ਜਾਨਵਰ ਬਹੁਤ ਪਸੰਦ ਹਨ ਕਿ ਪਹਿਲਾਂ ਮੈਂ ਅੱਜ ਤੋਂ ਵੀਹ ਸਾਲ ਪਹਿਲਾਂ ਖੇਤੀ ਕਰਦਾ ਸੀਗਾ ਤਾਂ ਮੈਂ ਬੈਲ ਜਿਹਨਾਂ ਨੂੰ ਬਲਦ ਵੀ ਆਖਦੇ ਹਨ ਇਹਨਾਂ ਨਾਲ ਮੈਂ ਬਹੁਤ ਖੇਤੀ ਕੀਤੀ ਹਨ ਅਤੇ ਮੈਨੂੰ ਬਹੁਤ ਫਾਇਦਾ ਹੋਇਆ ਹੈ ਕਿ ਮੇਰੇ ਪੁੱਤਾਂ ਨਾਲੋਂ ਵੀ ਮੈਨੂੰ ਮੈਨੂੰ ਕਮਾਈ ਖਿਲਾਂਦੇ ਸੀਗੇ ਮੈਨੂੰ ਬਹੁਤ ਪਸੰਦ ਹੈ ਅਤੇ ਬਾਕੀ ਪਾਲਤੂ ਪਸ਼ੂ ਮੱਝ ਮੱਝਾਂ ਵੀ ਰੱਖੀਆਂ ਹੋਈਆਂ ਹਨ ਅਤੇ ਉਹਨਾਂ ਦਾ ਸਾਨੂੰ ਦੁੱਧ ਬਹੁਤ ਪਸੰਦ ਹਨ ਉਸ ਤੋਂ ਸਾਨੂੰ ਬਹੁਤ ਲਾਭ ਹੁੰਦਾ ਹਨ ਦਹੀਂ ਮੱਖਣ ਘੇ ਬਰਫ਼ੀਆਂ ਹਰੇਕ ਪਦਾਰਥ ਬਣੇ ਜਾਂਦੇ ਹਨ ਉਸ ਤੋਂ ਬਾਅਦ ਮੱਝਾਂ ਤੋਂ ਬਾਅਦ ਮੈਂ ਹੁਣ ਗਾਇਆਂ ਵੀ ਰੱਖੀਆਂ ਹੋਈਆਂ ਹਨ ਕਿ ਗਾਏਂ ਦਾ ਇਹ ਹੈ ਕਿ ਜੇ ਕੱਟੂ ਮਰ ਜਾਵੇ ਤਾਂ ਗਾਏਂ ਨੂੰ ਦ ਗਾਏਂ ਦੁੱਧ ਚੋਣ ਲਈ ਬੰਦਾ ਖਾਲੀ ਨਹੀਂ ਮੁੜਦਾ ਜਿੰਨਾਂ ਵੀ ਹੈ ਮੌਕੇ 'ਤੇ ਚੌ ਕੇ ਘਰ ਲੈ ਕੇ ਆਉਂਦਾ ਹਨ ਉਸ ਤੋਂ ਮੈਂ ਉਪਰੰਤ ਪਾਲਤੂ ਪਸ਼ੂ ਇੱਕ ਕੁੱਤਾ ਰੱਖਿਆ ਹੋਇਆ ਹਨ ਅਤੇ ਪਾਕਿਸਤਾਨ ਬੁਲੀ ਹੈ ਅਤੇ ਜਿਸ ਜਿਸ ਦਾ ਪ੍ਰਸ਼ਾਦਾ ਪਾਣੀ ਇੱਕ ਕਿੱਲੋ ਰਾਸਨ ਰੋਜ਼ ਖਾਂਦਾ ਹੈ ਅਤੇ ਇੱਕ ਕਿੱਲੋ ਦੁੱਧ ਵੀ ਪੀਂਦਾ ਹਨ ਉਹ ਜਦੋਂ ਬਾਹਰ ਜਾਂਦਾ ਹਨ ਬਾਈ ਦੀ ਬੇਅ ਨਿੱਕਲ ਜਾਂਦਾ ਹਨ ਅਤੇ ਉਹ ਘੁੰਮ ਫਿਰ ਕੇ ਆ ਜਾਂਦਾ ਕਿਸੇ ਨੂੰ ਕੁਛ ਨਹੀਂ ਬੋਲਦਾ ਜਦੋਂ ਮੇਰੇ ਘਰ ਬੰਦਾ ਆ ਕੇ ਕੋਈ ਚੀਜ਼ ਨੂੰ ਹੱਥ ਪਾਉਂਦਾ ਹੈ ਤਾਂ ਉਹ ਅੱਗੇ ਖੜ੍ਹ ਕੇ ਘੂਰੀ ਵੱਟ ਦਾ ਗੁੱਸੇ ਵਿੱਚ ਦੇਖਦਾ ਹੈ ਜੇ ਬੰਦੇ ਨੇ ਚੀਜ਼ ਰੱਖ ਦਿੱਤੀ ਹੈ ਤਾਂ ਠੀਕ ਆ ਨਹੀਂ ਤੋਂ ਫਿਰ ਉਹ ਖਤਰੇ ਦੇ ਵਿੱਚ ਸ਼ੁਰੂ ਹੋ ਜਾਂਦਾ ਹਨ ਜਦੋਂ ਅਸੀਂ ਉਸ ਨੂੰ ਕਹਿੰਦੇ ਹਨ ਉਸਦਾ ਉਸਦਾ ਨਾਮ ਅਸੀਂ ਜੈਕ ਰੱਖਿਆ ਹੋਇਆ ਹਨ ਵੀ ਜੈਕ ਚੱਲ ਅੰਦਰ ਤਾਂ ਅੰਦਰ ਆ ਜਾਂਦਾ ਹੈ ਜਦੋਂ ਵੀ ਕ ਉਸ ਨੂੰ ਬੰਦਿਆਂ ਵਾਂਗੂੰ ਬੋਲਦੇ ਹਨ ਵੀ ਚੱਲ ਉੱਥੇ ਬੈਠ ਤਾਂ ਉੱਥੇ ਬੈਠ ਵੀ ਜਾਂਦਾ ਹਨ ਅਤੇ ਸਾਡਾ ਪ੍ਰਸ਼ਾਦਾ ਪਾਣੀ ਚੁੱਲ੍ਹੇ ਦੇ ਕੋਲ ਪਿਆ ਰਹਿੰਦਾ ਹਨ ਪਰ ਉਸ ਨੇ ਨੇੜੇ ਨਹੀਂ ਆਉਣਾ ਰੋਟੀ ਵੀ ਉਹਨੂੰ ਬ ਜਦ ਤੱਕ ਅਸੀਂ ਬੋਲਦੇ ਨਈਂ ਜਦ ਤੱਕ ਉਹਨੇ ਨਹੀਂ ਖਾਣੀ